ਯਲਡਿੰਗ ਖੇਤੀ ਬਾਰੇ ਮੈਨੂੰ ਇੰਨਾ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਪਰ ਹਾਂ ਜਿਵੇਂ ਸਾਡੇ ਖੇਤਰ ਦੇ ਵਿੱਚ ਜਿਹੜੀਆਂ ਵੀ ਫਸਲਾਂ ਹੁੰਦੀਆਂ ਜਿਵੇਂ ਨਰਮਾ ਹੁੰਦੀ ਆ ਕਪਾਹ ਹੋ ਗਿਆ ਆਪਣਾ ਝੋਨਾ ਹੋ ਗਿਆ ਕਣਕ ਹੋ ਗਿਆ ਉਸ ਵਿੱਚ ਅੱਜ ਕੱਲ੍ਹ ਵਪਾਰੀ ਆਪਦੇ ਪੈਸੇ ਲਾਉਂਦੇ ਆ ਸ਼ੇਅਰ ਲਾਉਂਦੇ ਨੇ ਅਤੇ ਉਸ ਤਰ੍ਹਾਂ ਆਪਣਾ ਵਪਾਰ ਕਰਦੇ ਨੇ ਅਤੇ ਫਸਲਾਂ ਅਗਾਂਹ ਮੰਡੀਕਰਨ ਕਰਦੇ ਨੇ ਉਹਨਾਂ ਦਾ ਆਪ ਰੁਝਾਨ ਦੇ ਕੇ ਵੱਡੇ ਵੱਡੇ ਸੈਕਟਰਾਂ 'ਚ ਦੇ ਕੇ ਉਸ ਦੀ ਪੈਦਾਵਾਰ ਕਰਦੇ ਨੇ ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਕਿਸਾਨ ਨੇ ਪਹਿਲਾਂ ਵਾਲੇ ਕਿਸਾਨਾਂ ਨਾਲੋਂ ਬਹੁ ਫਰਕ ਰਹਿ ਗਿਆ ਹੁਣ ਕਿਸਾਨ ਤਰੱਕੀ ਵੱਲ ਨੂੰ ਜਾ ਰਹੇ ਨੇ ਪੜ੍ਹੇ ਲਿਖੇ ਕਿਸਾਨ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਆਪਦੀ ਫਸਲ 'ਚੋਂ ਕਿਵੇਂ ਇਨਵੈਸਟ ਕਰਕੇ ਜਾਂ ਕਿਵੇਂ ਆਪਦੇ ਖੇਤਰ ਦੇ ਵਿੱਚ ਪੈਸੇ ਲਾ ਕੇ ਜਾਂ ਕਿਵੇਂ ਆਪਣਾ ਵਪਾਰੀਆਂ ਨਾਲ ਕਰਕੇ ਅਸੀਂ ਕਿਵੇਂ ਵੱਧ ਤੋਂ ਵੱਧ ਪੈਸੇ ਬਣਾ ਸਕੀਏ